ਹੈਲੋ ਹਾਂਜੀ ਮੈਮ ਤੁਸੀਂ ਬੁੱਕ ਐਡੀਟਰ ਬੋਲ ਰਹੇ ਓ ਹਾਂਜੀ ਮੈਮ ਮੈਂ ਇੱਕ ਬੁੱਕ ਲਿਖੀ ਸੀ ਕਹਾਣੀਆਂ ਤੇ ਮੈਮ ਮੈਂ ਉਹ ਪਬਲਿਸ਼ ਕਰਵੋਣੀ ਸੀ ਬੁੱਕ ਹਾਂਜੀ ਮੈਮ ਤੁਸੀਂ ਮੈਨੂੰ ਦੱਸ ਸਕਦੇ ਓ ਕਿ ਉਹਦੇ ਕਿੰਨੀ ਕੋਸਟ ਲੱਗੂਗੀ ਤੇ ਕਦੋਂ ਤੱਕ ਪਬਲਿਸ਼ ਹੋਜੇਗੀ ਮੈਮ ਉਹਦੇ ਵਿੱਚ ਘੱਟ ਤੋਂ ਘੱਟ ਸੌ ਦੇ ਲਗਪਗ ਪੇਜ ਹੈਗੇ ਐ ਬਸ ਮੈਮ ਕੋਈ ਪੰਦਰਾਂ ਵੀਹ ਦਿਨਾਂ ਤੱਕ ਹੋਜੇ ਪਬਲਿਸ਼ ਤਾਂ ਵਧੀਆ ਐ ਜਲਦੀ ਤੋਂ ਜਲਦੀ ਜਿਆਦਾ ਟਾਈਮ ਵੀ ਨਾ ਲੱਗੇ ਹਾਂਜੀ ਮੈਮ ਤੇ ਮੈਮ ਕਿੰਨੀ ਕੋਸਟ ਲਓਗੇ ਫੇਰ ਤੁਸੀਂ ਇਹ ਦੱਸ ਦੋ ਤੇ ਜੀ ਮੈਮ ਕੋਈ ਲੈੱਸ ਲੁੱਸ ਨੀ ਹੋ ਸਕਦਾ ਹਾਂਜੀ ਪੇਜ ਤੋ ਜਿਆਦਾ ਬਣ ਰਹੇ ਨੇ ਫਿਰ ਵੀ ਤੁਸੀਂ ਕੁਛ ਡਿਸਕਾਊਂਟ ਕੁਛ ਵੀ ਡਿਸਕਾਊਂਟ ਦੇ ਸਕਦੇ ਓ ਜਾਂ ਥੋੜਾ ਬਹੁਤ ਲੈੱਸ ਕਰ ਸਕਦੇ ਓ ਤਾਂ ਦੱਸ ਦੋ ਚਲੋ ਠੀਕ ਐ ਕੋਈ ਗੱਲ ਨੀ ਪੈਸਿਆਂ ਦੀ ਤੇ ਤੁਸੀਂ ਮਤਲਬ ਵਧੀਆ ਪਬਲਿਸ਼ ਕਰ ਕੇ ਦੇਣਾ ਐ ਆਪਣੇ ਅੱਖਰ ਅਖੁਰ ਸਹੀ ਬਿਲਕੁਲ ਹੋਣੇ ਚਾਈਦੇ ਐ ਜਿਵੇਂ ਕਈ ਵਾਰ ਕੀ ਹੁੰਦਾ ਕੇ ਅੱਖਰਾਂ ਦਾ ਪਤਾ ਨੀ ਲੱਗਦਾ ਤਾਂ ਉਹੋ ਜਿਹੀ ਕੋਈ ਦਿੱਕਤ ਤਾਂ ਨੀ ਆਊਗੀ ਨਾ ਤੁਹਾਡੇ ਪਬਲਿਸ਼ ਕਰਵੋਣ ਵਿੱਚ ਹਾਂਜੀ

ਹਾਂਜੀ ਹਾਂਜੀ ਬਸ ਇਹੀ ਐ ਕੀ ਬੁੱਕ ਬੁੱਕ ਜਿਹੜੀ ਆਪਣੇ ਚੰਗੀ ਤਰ੍ਹਾਂ ਵਧੀਆ ਪਬਲਿਸ਼ ਹੋਜੇ ਕੋਈ ਦਿੱਕ ਮਤਲਬ ਉਹਦੇ ਵਿੱਚ ਹੋਵੇ ਨਾ ਕੋਈ ਹਾਂਜੀ ਕੋਈ ਗੱਲ ਨੀ ਬਸ ਮੈਂ ਕੱਲ ਈ ਆਜਾਂਗੀ ਹਾਂਜੀ ਇਹ ਤਾਂ ਤੁਹਾਡੀ ਗੱਲ ਸਹੀ ਐ ਬਸ ਕੋਈ ਗੱਲ ਨੀ ਅਸੀਂ ਮੈਂ ਕੱਲ ਈ ਆਜਾਂਗੀ ਬੁੱਕ ਬੁੱਕ ਮੇਰੀ ਹੈਗੀ ਬਸ ਕੰਪਲੀਟ ਐ ਬੁੱਕ ਤਾਂ ਮੇਰੀ ਤੇ ਬਸ ਤੁਸੀਂ ਪਬਲਿਸ਼ ਕਰ ਦਿਓ ਬਸ ਹਾਂਜੀ ਹਾਂਜੀ ਹਾਂਜੀ ਬਸ ਹਾਂਜੀ ਇਹੀ ਐ ਕੀ ਜੋ ਵੀ ਆਪਾਂ ਲਿਖਿਆ ਉਹ ਸਹੀ ਤਰੀਕੇ ਨਾਲ ਜਿਹੜੇ ਪਾਠਕ ਹੈਗੇ ਐ ਆਪਣੇ ਉਨ੍ਹਾਂ ਤੱਕ ਪਹੁੰਚ ਸਕੇ ਆਪਣੀ ਗੱਲ ਕੋਈ ਐ ਹਾਂਜੀ ਹਾਂਜੀ ਚਲੋ ਫੇਰ ਮੈਮ ਠੀਕ ਐ ਆਪਾਂ ਕੱਲ ਮਿਲਦੇ ਐ ਫੇਰ ਮੈਂ ਓਥੇ ਈ ਆਪਾਂ ਸਾਰੀ ਗੱਲ ਬਾਕੀ ਜਿਹੜੀ ਕੋਈ ਰਹਿੰਦੀ ਓਥੇ ਈ ਕਰਾਂਗੇ ਫੇਰ ਕਰਦੇ ਆਂ ਚੰਗੀ ਤਰ੍ਹਾਂ ਡਿਸਕਸ ਹਾਂਜੀ ਮੈਮ ਜਰੂਰ ਜੀ ਮੈਂ ਸਵੇਰੇ ਟਾਈਮ ਨਾਲ ਈ ਆਪਾਂ ਮਿਲਾਂਗੇ ਤੇ ਫੇਰ ਕੱਠੇ ਓਥੇ ਗੱਲ ਕਰਲਾਂਗੇ ਸਾਰੀ ਤੇ ਹਾਂਜੀ ਓਕੇ ਮੈਮ